ਪੰਜਾਬ ਵਿੱਚ ਮੁੱਖ ਬੈਂਕਿੰਗ ਜਾਂ ਬੀਮ ਬੀਮਾ ਕੈਰੀਅਰ ਉਹਨਾਂ ਦੇ ਮੌਕੇ ਦੇ ਸੰਭਾਵਨਾਵਾਂ ਦੇਖੋ ਮੈਂ ਤਾਂ ਕਹਿੰਦੀ ਹਾਂ ਕਿ ਬਹੁਤ ਹੈਗੀਆਂ ਕਿਉਂਕਿ ਬੀਮਾ ਦੇ ਵਿੱਚ ਤੁਹਾਨੂੰ ਇੱਕ ਇੰਡੀਪੈਂਡੈਂਟ ਕਹਿ ਲਓ ਵੀ ਇੱਕ ਕੈਰੀਅਰ ਮਿਲ ਜਾਂਦਾ ਤੁਹਾਡੀ ਜਿਹਦੇ 'ਤੇ ਤੁਹਾਡੇ 'ਤੇ ਕੋਈ ਬੋਸ ਨਹੀਂ ਹੈਗਾ ਹੈ ਨਾ ਅਤੇ ਤੁਸੀਂ ਆਪਣਾ ਇੱਕ ਬਿਜ਼ਨਸ ਟਾਈਪ ਉਹਨੂੰ ਕਰ ਸਕਦੇ ਹੋ ਤੁਸੀਂ ਤੁਹਾਡਾ ਜਦੋਂ ਮਨ ਕਰੇ ਤੁਸੀਂ ਕੰਲਾਈਟ ਨੂੰ ਜਾ ਕੇ ਮਿਲ ਸਕਦੇ ਹੋ ਅਤੇ ਆਪਣਾ ਕੰਮ ਕਰ ਸਕਦੇ ਹੋ ਤੁਹਾਡੀ ਇਹਦੇ ਨਾਲ ਅੱਛੀ ਇਨਕਮ ਵੀ ਹੋ ਜਾਂਦੀ ਆ ਅਤੇ ਤੁਸੀਂ ਘਰ ਬੈਠੇ ਵੀ ਕੰਮ ਕਰ ਸਕਦੇ ਹੋ ਤੁਸੀਂ ਫੋਨ 'ਤੇ ਵੀ ਇਹ ਕੰਮ ਕਰ ਸਕਦੇ ਹੋ ਅੱਜ ਕੱਲ੍ਹ ਤਾਂ ਸਾਰਾ ਆਨਲਾਈਨ ਹੋ ਗਿਆ ਕਿਸੇ ਨੂੰ ਉਹਨਾਂ ਦੇ ਲਾਈਫ ਬਾਰੇ ਦੱਸਣਾ ਜਾਂ ਜਿੱਦਾਂ ਸਿਹਤ ਬੀਮਾ ਵੀ ਹੁਣ ਹੈਗਾ ਹੈ ਨਾ ਅਤੇ ਉਹਨਾਂ ਚੀਜ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੋ ਉਹਦੇ ਉਹ ਨਾਲ ਤੁਹਾਨੂੰ ਇੱਕ ਅੱਛੀ ਇਨਕਮ ਵੀ ਹੁੰਦੀ ਆ ਅੱਛਾ ਪੈਸਾ ਵੀ ਹੈ ਅਤੇ ਤੁਸੀਂ ਆਪਣਾ ਆਪਣੇ ਕੈਰੀਅਰ ਵਧੀਆ ਬਣਾ ਸਕਦੇ ਹੋ ਬੀਮੇ ਦੇ ਵਿੱਚ